ਪੰਜਾਬ ਵਿੱਚ ਜੀਰੀ ਦੀ ਫਸਲ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਚਾਵਲ ਨੂੰ ਜੋ ਕਿ ਤੀਹ ਦਿਨ ਅਸੀਂ ਉਸਦੀ ਫੱਕ ਉਗਾਉਂਦੇ ਹਾਂ ਅਤੇ ਬਾਅਦ ਵਿੱਚ ਉਸ ਨੂੰ ਖੇਤ ਵਿੱਚ ਲਾਇਆ ਜਾਂਦਾ ਹੈ ਜਿਸ ਨੂੰ ਤੋਂ ਅਸੀਂ ਬਾਸਪਤੀ ਚਾਵਲ ਬਜ਼ਾਰ ਵਿੱਚ ਸੇਲ ਕਰਦੇ ਹਾਂ ਜੋ ਕਿ ਬਹੁਤ ਮਹਿੰਗੇ ਵਿਕਦੇ ਹਨ ਜਿਸ ਤੋਂ ਸਾਨੂੰ ਕਾਫੀ ਆਮਦਨ ਹੁੰਦੀ ਹੈ ਜਿਸ 'ਤੇ ਸਪਰੇਅ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ ਅਤੇ ਸਮਾਂ ਵੀ ਬਹੁਤ ਘੱਟ ਲੈਂਦੀ ਹੈ ਇਸ ਤੋਂ ਅਸੀਂ ਥੋੜ੍ਹੇ ਜਿਹੇ ਚਾਵਲ ਘਰੇ ਰੱਖ ਕੇ ਸਾਰਾ ਸਾਲ ਆਪਣੇ ਘਰ ਦੇ ਚਾਵਲਾਂ ਦੀ ਵਰਤੋਂ ਕਰਦੇ ਹਾਂ ਅਤੇ ਖਾਣ ਵਿੱਚ ਸੰਤੁਸ਼ਟੀ ਆਉਂਦੀ ਹੈ ਇਸ ਤੋਂ ਅਗਲੀ ਫਸਲ ਅਸੀਂ ਸਰਦੀਆਂ ਦੀ ਜੋ ਕਿ ਆਪਾਂ ਹਾੜੀ ਦੀ ਫਸਲ ਕਹਿ ਦਿੰਦੇ ਹਾਂ ਉਹ ਸਰ੍ਹੋਂ ਦੀ ਫਸਲ ਲਗਾਉਂਦੇ ਹਾਂ ਜਿਸ ਨੂੰ ਪਾਣੀ ਦੀ ਲੋੜ ਵੀ ਬਹੁਤ ਘੱਟ ਪੈਂਦੀ ਹੈ ਅਤੇ ਖਰਚਾ ਵੀ ਬਹੁਤ ਘੱਟ ਹੁੰਦਾ ਹੈ ਜਿਸ ਤੋਂ ਆਮਦਨ ਸਾਨੂੰ ਜ਼ਿਆਦਾ ਹੁੰਦੀ ਹੈ ਸਰ੍ਹੋਂ ਦਾ ਤੇਲ ਵੀ ਅਸੀਂ ਘਰ ਰੱਖ ਕੇ ਕਢਾਉਂਦੇ ਹਾਂ ਸਰ੍ਹੋਂ ਦੇ ਤੇਲ ਵਿੱਚ ਸਬਜ਼ੀਆਂ ਬਣਾਉਂਦੇ ਹਾਂ ਸਰਸੋਂ ਦਾ ਬੀਜ ਵੀ ਅਸੀਂ ਆਪਣਾ ਤਿਆਰ ਕਰਦੇ ਹਾਂ ਸਰੋਂ 'ਤੇ ਸਪਰੇ ਵੀ ਘੱਟ ਹੁੰਦੀ ਹੈ ਖਰਚ ਘੱਟ ਹੁੰਦਾ ਹੈ ਅਤੇ ਆਮਦਨ ਜ਼ਿਆਦਾ ਹੁੰਦੀ ਹੈ ਸਰ੍ਹੋਂ ਦੀ ਬਿਜਾਈ ਤੋਂ ਲੈ ਕੇ ਵਢਾਈ ਤੱਕ ਦਾ ਸਮਾਂ ਤਕਰੀਬਨ ਤਿੰਨ ਮਹੀਨਿਆਂ ਦਾ ਹੁੰਦਾ ਹੈ ਜਿਸ ਜਿਸ ਦੀ ਰਹਿੰਦ ਖੂੰਦ ਵੀ ਭੱਠਿਆਂ ਉੱਤੇ ਸੇਲ ਹੋ ਜਾਂਦੀ ਹੈ ਸਰ੍ਹੋਂ ਸਾਨੂੰ ਬਹੁਤ ਲਾਭਦਾਇਕ ਫਸਲ ਹੈ